ਥੋੜ੍ਹੇ ਦਿਨ ਪਹਿਲੇ ਮੈਂ ਔਨਲਾਈਨ ਕੁਛ ਨਾ ਪਲਾਸਟਿਕ ਕੰਟੇਨਰ ਔਡਰ ਕੀਤੇ ਸੀ ਅਤੇ ਬਹੁਤ ਮੈਂ ਬਣਿਆ ਬੜੀ ਖੁਸ਼ੀ ਖੁਸ਼ੀ ਕੰਟੇਨਰ ਔਡਰ ਕੀਤੇ ਸੀ ਕਿ ਬਹੁਤ ਘੱਟ ਪ੍ਰਾਈਜ਼ ਜਿਸ ਤਰ੍ਹਾਂ ਮੈਨੂੰ ਅੱਠ ਕੰਟੇਨਰ ਮਿਲ ਰਹੇ ਹੈ ਪਰ ਜਦੋਂ ਮੈਂ ਉਹ ਆਪਣਾ ਪਾਰਸਲ ਰਿਸੀਵ ਕੀਤਾ ਤਾਂ ਮੈਨੂੰ ਬੜਾ ਦੁੱਖ ਲੱਗਾ ਇੱਕ ਤਾਂ ਉਹ ਬਹੁਤ ਹੀ ਕਟੇ ਫਟਿਆ ਜਿਹਾ ਸਾਰਾ ਪਾਰਸਲ ਸੀਗਾ ਅਤੇ ਜਦੋਂ ਮੈਂ ਖੋਲ੍ਹੇ ਉਹਨਾਂ ਨੇ ਦਿਖਾਏ ਤਾਂ ਅੱਠ ਕੰਟੇਨਰ ਸੀ ਪਰ ਵਿੱਚੋਂ ਨਿਕਲਿਆ ਛੇ ਕੰਟੇਨਰ ਸਭ ਤੋਂ ਪਹਿਲਾਂ ਤਾਂ ਮੈਂ ਉਦੋਂ ਮੇਰਾ ਮਨ ਦੁੱਖ ਗਿਆ ਫਿਰ ਦੂਸਰਾ ਜਦੋਂ ਮੈਨੂੰ ਯੂਜ ਕਰਨੇ ਸ਼ੁਰੂ ਕੀਤੇ ਤਾਂ ਤਾਂ ਵੀ ਮੈਨੂੰ ਬਹੁਤ ਹੀ ਹਰਟ ਫੀਲ ਹੋਇਆ ਕਿਉਂਕਿ ਉਹਦੇ ਵਿੱਚ ਨਾ ਮੈਂ ਇੱਕ ਦਿਨ ਕੀ ਹੋਇਆ ਮਟਰੀ ਪਾਈ ਅਤੇ ਮਟਰੀ ਦਾ ਸਾਰਾ ਰੰਗ ਬਲਿਊ ਕਲਰ ਦਾ ਹੋ ਗਿਆ ਕਿਉਂਕਿ ਮੈਨੂੰ ਸਮਝ ਨਾ ਆਏ ਕਿ ਇਹ ਮਟਰੀ ਕਿਉਂ ਬਲਿਊ ਕਲਰ ਦੀ ਹੋ ਗਈ ਹੈ ਫਿਰ ਬਾਅਦ 'ਚ ਮੈਂ ਦੇਖਿਆ ਨੋਟਿਸ ਕੀਤਾ ਕਿ ਜਿਹੜੇ ਉਹਦੇ ਉੱਪਰ ਢੱਕਣ ਲੱਗਾ ਹੋਇਆ ਸੀ ਨੀਲੇ ਰੰਗ ਦਾ ਉਹਦਾ ਸਾਰਾ ਰੰਗ ਉੱਤਰ ਉੱਤਰ ਕੇ ਉਹ ਮਟਰੀ ਨੂੰ ਲੱਗ ਰਿਹਾ ਸੀਗਾ ਅਤੇ ਦੇਖੋ ਕਿੰਨਾ ਟੋਸਿਕ ਹੁੰਦਾ ਉਹਦੇ ਵਿੱਚ ਕਿੰਨਾ ਕਿੰਨਾ ਕੈਮੀਕਲ ਹੁੰਦਾ ਕਿ ਜਿਹੜਾ ਕਿ ਉਹ ਸਾਰਾ ਮਟਰੀ ਨੂੰ ਲੱਗ ਰਿਹਾ ਸੀ ਅਤੇ ਜਿਹਨੇ ਸਾਡੀ ਹੈਲਥ ਨੂੰ ਵੀ ਖਰਾਬ ਕਰ ਦੇਣਾ ਸੀਗਾ ਇਹਨਾਂ ਚੀਜ਼ਾਂ ਦਾ ਕੰਪਨੀ ਵਾਲਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਕਿ ਇੱਕ ਇੱਕ ਪਲਾਸਟਿਕ ਦਾ ਇੱਕ ਉਹ ਕਲਰ ਇੱਕ ਖਾਣ ਵਾਲੀ ਚੀਜ਼ ਨੂੰ ਲ ਲੱਗ ਰਿਹਾ ਸੀਗਾ ਅਤੇ ਮੈਂ ਮੈਂ ਈਵਨ ਕਿ ਆਪਣੀ ਫਰੈਂਡ ਨੂੰ ਦੱਸਿਆ ਕਿ ਬੜੇ ਘੱਟ ਪ੍ਰਾਈਜ਼ 'ਤੇ ਨਾ ਉਹ ਕੰਟੇਨਰ ਅੱਠ ਮਿਲਦੇ ਪਏ ਨੇ ਉੱਥੋਂ ਅਤੇ ਤੂੰ ਵੀ ਔਡਰ ਕਰਲਾ ਮੈਂ ਫਟਾਫਟ ਫਿਰ ਆਪਣੀ ਫਰੈਂਡ ਨੂੰ ਕਿਹਾ ਕਿ ਤੂੰ ਤੂੰ ਪਲੀਜ਼ ਉਹ ਆਪਣਾ ਔਡਰ ਕੈਂਸਲ ਕਰਦੇ ਤਾਂ ਕਿ ਤੇਰਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਆਪਾਂ ਮੋਸਟਲੀ ਜਿਹੜੇ ਕੰਟੇਨਰ ਹੁੰਦੇ ਉਹਦੇ 'ਚ ਆਪਾਂ ਖਾਣ ਪੀਣ ਵਾਲਾ ਸਮਾਨ ਪਾ ਰਹੇ ਹਾਂ ਅਤੇ ਉਹਦਾ ਫਿਰ ਫਾਇਦਾ ਕੀ ਜੇ ਉਸ ਕੰਟੇਨਰ ਦਾ ਰੰ ਰੰਗ ਉੱਤਰ ਉੱਤਰ ਕੇ ਉਸ ਚੀਜ਼ ਨੂੰ ਲੱਗ ਰਿਹਾ ਜਿਹੜਾ ਕਿ ਆਪਾਂ ਚੀਜ਼ ਖਾਣੀ ਹੈਗੀ ਸੋ ਮੇਰਾ ਸੁਝਾਉ ਸਾਰਿਆਂ ਨੂੰ ਇਹ ਹੈ ਕਿ ਕੋਈ ਵੀ ਚੀਜ਼ ਆਪਾਂ ਤੁਸੀਂ ਔਨਲਾਈਨ ਮੰਗਵਾਉਂਦੇ ਹੋ ਸੋਚ ਸਮਝ ਕੇ ਮੰਗਵਾਉ ਕਿ ਜਿਹੜੀ ਸਾਡੀ ਹੈਲਥ ਨੂੰ ਨੁਕਸਾਨ ਨਾ ਕਰੇ